ਸਾਡੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਮੈਕਸ ਹੋਸਪਿਟਲ ਛੇ ਫੇਸ ਦੇ ਵਿੱਚ ਬਹੁਤ ਚੰਗਾ ਇਲਾਜ ਹੋ ਰਿਹਾ ਹੈਗਾ ਜੀ ਉੱਥੇ ਕਾਫੀ ਮਰੀਜ਼ ਦੂਰੋਂ ਦੂਰੋਂ ਆਉਂਦੇ ਹਨ ਚਾਵਲਾ ਹੋਸਪੀਟਲ ਵੀ ਬਹੁਤ ਮਸ਼ਹੂਰ ਹੈ ਉੱਥੇ ਡਾਕਟਰ ਸਟਾਫ ਬਹੁਤ ਚੰਗਾ ਹੈ ਸਾਰੇ ਇਲਾਜ ਉੱਥੇ ਕੀਤੇ ਜਾਂਦੇ ਹਨ ਅਤੇ ਚੀ ਚੀਮਾ ਹੋਸਪਿਟਲ ਦੇ ਵਿੱਚ ਵੀ ਅੱਖਾਂ ਦਾ ਔਰ ਅ ਨੱਕ ਦਾ ਅਪ੍ਰੇਸ਼ਨ ਬਹੁਤ ਵਧੀਆ ਚੰਗੀ ਤਰ੍ਹਾਂ ਅਤੇ ਇਲਾਜ ਚੱਲਦਾ ਹੈਗਾ ਪੀ ਜੀ ਆਈ ਦੇ ਵਿੱਚ ਦੂਰੋਂ ਦੂਰੋਂ ਲੋਕ ਆਉਂਦੇ ਬਹੁਤ ਸਟਾਫ ਚੰਗੇ ਡਾਕਟਰ ਬਹੁਤ ਵਧੀਆ ਇਲਾਜ ਕਰਦੇ ਹਨ ਹਰੇਕ ਚੀਜ਼ ਦਾ ਉੱਥੇ ਇਲਾਜ ਕੀਤਾ ਜਾਂਦਾ ਹੈਗਾ ਜੀ ਸੋਲ੍ਹਾਂ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਵਧੀਆ ਸਹੂਲਤ ਹੈਗੀ ਹੈ ਔਰ ਕਾਫੀ ਮਰੀਜ਼ਾਂ ਦਾ ਉੱਥੇ ਇਲਾਜ ਕੀਤਾ ਜਾਂਦਾ ਹੈਗਾ ਡਾਕਟਰ ਔਰ ਸਿਸਟਰ ਨਰਸ ਸਟਾਫ ਬਹੁਤ ਚੰਗੇ ਹਨ ਪਿੰਡ ਵਿੱਚ ਵੀ ਇੱਕ ਸਾਡੇ ਡਿਸਪੈਂਸਰੀ ਹੈਗੀ ਹੈ ਉੱਥੇ ਡਾਕਟਰ ਵੀ ਬਹੁਤ ਵਧੀਆ ਚੰਗੀ ਚੰਗਾ ਉੱਥੇ ਚੰਡੀਗੜ੍ਹ ਤੋਂ ਆਉਂਦਾ ਹੈ ਬਹੁਤ ਦਵਾਈਆਂ ਦੇ ਕੇ ਬੰਦਿਆਂ ਨੂੰ ਠੀਕ ਕਰਦਾ ਹੈਗਾ ਜੀ